ਜਿਹੜੀ ਪੰਜਾਬੀ ਭਾਸ਼ਾ ਹੈ ਨਾ ਪੰਜਾਬੀ ਕੀ ਇੱਕ ਇੰਡੋ ਆਰੀਅਨ ਭਾਸ਼ਾ ਹੈਗੀ ਆ ਅਤੇ ਜੋ ਕਿ ਇਤਿਹਾਸਿਕ ਪੰਜਾਬ ਇਲਾਕੇ ਦੇ ਵਸਨੀਕਾਂ ਤਾਂ ਦੁਆਰਾ ਬੋਲੀ ਜਾਂਦੀ ਹੈਗੀ ਆ ਪੰਜਾਬੀ ਜਿਹੜੀ ਹੈਗੀ ਆ ਪੰਜਾਬ ਦੀ ਭਾਸ਼ਾ ਵਾ ਅਤੇ ਜਿਹੜੀ ਆਪਾਂ ਕਹਿ ਸਕਦੇ ਹੈਗੇ ਹਾਂ ਜੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਇੱਕ ਦੂਜੇ ਨਾਲ ਹੀ ਬੋਲਦੇ ਹੈਗੇ ਆ ਜਿਹੜਾ ਪੰਜਾਬ ਦਾ ਪਹਿਲਾ ਪੰਜਾਬ ਰਾਜ ਭਾਸ਼ਾ ਐਕਟ ਸੀ ਉਹ ਉੱਨੀ ਸੌ ਸੱਠ ਵਿੱਚ ਜਿਹੜਾ ਹੈਗਾ ਸੀ ਉਹ ਬਣਿਆ ਸੀ ਅਤੇ ਜੇ ਮੈਂ ਗੱਲ ਕਰਾਂ ਕਿ ਉਪਭਾਸ਼ਾ ਤਾਂ ਉਪਭਾਸ਼ਾ ਕੀ ਹੈ ਕਿ ਉਹ ਮੀਨਜ਼ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਇੱਕ ਛੋਟੇ ਜਿਹੇ ਹਿੱਸੇ ਵਾਲੀ ਬੋਲੇ ਬੋਲੀ ਜਾਂਦੀ ਇਲਾਕੇ ਵਿੱਚ ਉਹਨੂੰ ਆਪਾਂ ਉਪ ਭਾਸ਼ਾ ਕਹਿੰਦੇ ਹੈਗੇ ਹਾਂ ਜਿਵੇਂ ਮਾਝੇ ਦੇ ਲੋਕ ਮਾਝੀ ਬੋਲਦੇ ਆ ਜਿਵੇਂ ਤਰਨ ਤਾਰਨ ਵਾਲੀ ਸਾਈਡ ਹੈਗੀ ਆ ਉੱਥੇ ਸਾਰੇ ਕੀ ਆ ਮਾਝੀ ਹੀ ਬੋਲਦੇ ਹੈਗੇ ਆ ਅਤੇ ਕਈ ਲੋਕ ਕੀ ਹੈਗੇ ਆ ਦੁਆਬੀ ਬੋਲਦੇ ਆ ਕਈ ਲੋਕ ਕੀ ਆ ਮਲਵਈ ਬੋਲਦੇ ਹੈਗੇ ਆ ਅਤੇ ਜਿਹੜਾ ਮਾਝੇ ਤੋਂ ਨਾਮ ਪਿਆ ਵਾ ਮਾਝੀ ਠੀਕ ਆ ਅਤੇ ਜਿਹੜੇ ਮਾਝੇ ਦੇ ਲੋਕ ਆ ਉਹਨਾਂ ਆਪਾਂ ਮਝੈਲ ਕਹਿ ਦਿੰਦੇ ਹੈਗੇ ਹਾਂ ਅਤੇ ਜਿਵੇਂ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਦੁਆਬੀ ਭਾਸ਼ਾ ਹੋ ਗਈ ਠੀਕ ਆ ਜਿਹੜੀ ਦੁਆਬੀ ਆ ਉਹ ਫਾਰਸੀ ਭਾਸ਼ਾ ਦਾ ਇੱਕ ਸ਼ਬਦ ਹੈਗਾ ਵਾ ਮੀਨਜ ਆਪਾਂ ਕਹਿ ਸਕਦੇ ਹਾਂ ਕਿ ਦੁਆਬੀ ਭਾਸ਼ਾ ਕਿੱਥੇ ਕਿੱਥੇ ਬੋਲੀ ਜਾਂਦੀ ਆ ਜਲੰਧਰ ਹੋ ਗਿਆ ਹੁਸ਼ਿਆਰਪੁਰ ਕਪੂਰਥਲਾ ਨਵਾਂਸ਼ਹਿਰ ਇਹਨਾਂ 'ਚ ਬੋਲੀ ਜਾਂਦੀ ਹੈਗੀ ਆ ਅਤੇ ਇਸ ਤਰ੍ਹਾਂ ਹੀ ਕੀ ਹੈਗੀਆਂ ਵਾਂ ਵੱਖ ਵੱਖ ਲੈਂਗੁਏਜਜ ਹੈਗੀਆਂ ਵਾਂ ਜਿਵੇਂ ਉਪਭਾਸ਼ਾ ਹੋ ਗਈ ਆਪਣੀ ਮਲਵਈ ਮਲਵਈ ਜਿਹੜੀ ਹੈਗੀ ਆ ਉਹ ਬਠਿੰਡਾ ਫਰੀਦਕੋਟ ਵਿੱਚ ਬੋਲੀ ਜਾਂਦੀ ਹੈਗੀ ਆ ਅਤੇ ਪੰਜਾਬੀ ਭਾਸ਼ਾ ਤਾਂ ਪੂਰੇ ਪੰਜਾਬ 'ਚ ਬੋਲੀ ਜਾਂਦੀ ਹੈਗੀ ਆ ਪਰ ਪੰਜਾਬ ਦੇ ਵਿੱਚ ਛੋਟੇ ਛੋਟੇ ਇਲਾਕੇ ਮੈਂ ਜਿਵੇਂ ਕਹਿ ਸਕਦੀ ਹਾਂ ਤੁਹਾਨੂੰ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਤਰਨ ਤਾਰਨ ਹੋ ਗਿਆ ਬਠਿੰਡਾ ਹੋ ਗਿਆ ਫਰੀਦਕੋਟ ਹੋ ਗਿਆ ਇਹਨਾਂ ਸਾਰਿਆਂ ਵਿੱਚ ਜਿਹੜੀ ਲੈਂਗੁਏਜ ਟਵਿਸਟ ਹੈਗਾ ਉਹ ਥੋੜ੍ਹਾ ਚੇਂਜ ਹੋ ਜਾਂਦਾ ਵਾ ਜਿਵੇਂ ਤਰਨ ਤਾਰਨ 'ਚ ਤੁਹਾਨੂੰ ਮੈਂ ਦੱਸਿਆ ਕਿ ਮਾਝੀ ਬੋਲੀ ਜਾਂਦੀ ਹੈਗੀ ਆ ਅਤੇ ਬਠਿੰਡੇ ਵਿੱਚ ਜਿਹੜੀ ਹੈਗੀ ਆ ਆਪਣੀ ਮਲਵਈ ਬੋਲੀ ਜਾਂਦੀ ਹੈਗੀ ਆ ਅਤੇ ਜਲੰਧਰ ਵਿੱਚ ਜਿਹੜੀ ਆਪਣੀ ਉਹ ਦੁਆਬੀ ਬੋਲੀ ਜਾਂਦੀ ਹੈ ਥੋੜ੍ਹਾ ਲੈਂਗੁਏਜ ਨਾਲ ਟੱਚ ਹੈਗਾ ਥੋੜ੍ਹਾ ਕਿ ਡਿਫਰੈਂਟ ਹੋ ਜਾਂਦਾ ਵਾ